ਹੈਲੋ ਮੈਂ ਵਧੀਆ ਤੂੰ ਦੱਸ ਹਾਂ ਅਰਪਣ ਵਧੀਆ ਵਧੀਆ ਤੂੰ ਸੁਣਾ ਔਰ ਤੂੰ ਦੱਸ ਕਿਵੇਂ ਫੋਨ ਕੀਤਾ ਹੂੰ ਹਾਂ ਕਿਉਂ ਕੋਈ ਲਾਈਕ ਲਾਈਕ ਫਿਰ ਪਰਸਨਲ ਲਈ ਜਾਂ ਫੈਮਲੀ ਵਗੈਰਾ ਲਈ ਤੂੰ ਤੂੰ ਵਲੌਗਿੰਗ ਵਗੈਰਾ ਸਟਾਰਟ ਕੀਤੀ ਹੈ ਨਾ ਮੈਂ ਦੇਖੀ ਸੀ ਤੇਰੀ ਵੀਡੀਓ ਵਗੈਰਾ ਉਹਦੇ ਲਈ ਉਹਦੇ ਕੋਂਟੰਟ ਲਈ ਚਾਹੀਦਾ ਹਾਂ ਠੀਕ ਹੈ ਹਾਂ ਹਾਂ ਮੈਂ ਦੇਖਦੀ ਹੁੰਦੀ ਹਾਂ ਕਈ ਕਈ ਵਾਰ ਹਾਂ ਇੱਥੇ ਲਾਈਕ ਦ ਕਰਮ ਚੰਦ ਹੈ ਜੇ ਫੈਮਲੀ ਵਗੈਰਾ ਨਾਲ ਆਉਣਾ ਹੈ ਤਾਂ ਕਾਫ਼ੀ ਵਧੀਆ ਪਿਓਰ ਵੈਜੀਟੇਰੀਅਨ ਖਾਣਾ ਮਿਲਦਾ ਹੈ ਲਾਈਕ ਡੋਸਾ ਹੋ ਗਿਆ ਜਾਂ ਆਹ ਸਵੀਟ ਪਟੈਟੋ ਮਿਲਦੇ ਹੈ ਲਾਈਕ ਜੋ ਚੀਜ਼ਾਂ ਮੈਂ ਟ੍ਰਾਈ ਕੀਤੀਆਂ ਹੋਈਆਂ ਹਾਂ ਉਹਨਾਂ ਦੀ ਇੱਕ ਲਾਈਕ ਮਿਠਾਈ ਦੀ ਇੱਕ ਅਲੱਗ ਸ਼ੋਪ ਵੀ ਹੈਗੀ ਹੈ ਉਹ ਇੱਕ ਰੈਸਟੋਰੈਂਟ ਹੈ ਜਿੱਥੇ ਮਤਲਬ ਕਰਮ ਚੰਦ ਰੈਸਟੋਰੈਂਟ ਆ ਉਹ ਫਿਰ ਉਸ ਰੋਡ 'ਤੇ ਹੈਗਾ ਹੈ ਅਤੇ ਜਿਹੜਾ ਉਹ ਇਹਨਾਂ ਦੀ ਮਿਠਾਈ ਦੀ ਸ਼ੋਪ ਹੈ ਉਹ ਲੋਕਲ ਹੀ ਇੱਥੇ ਮਤਲਬ ਮਾ ਮੇਨ ਮਾਰਕੀਟ 'ਚ ਹੀ ਹੈ ਉੱਥੇ ਮਿਲ ਜਾਵੇਗਾ ਤੁਹਾਨੂੰ ਉੱਥੇ ਮਿਠਾਈ ਵਗੈਰਾ ਵਧੀਆ ਮਿਲ ਜਾਂਦੀ ਹੈ ਸਟੀਟ ਫੂਡ ਵੀ ਵਧੀਆ ਹੈਗਾ ਹੈ ਜਿਵੇਂ ਲੱਖਾਂ ਗੋਲ ਗੱਪਾ ਕਰਕੇ ਇੱਕ ਹੈ ਇੱਥੇ ਗੋਲ ਗੱਪੇ ਉੱਥੇ ਵਧੀਆ ਮਿਲ ਜਾਂਦੇ ਹੈ ਉਹ ਇੱਕ ਕੁਲਚੇ ਵਾਲਾ ਹੀ ਖੜ੍ਹਦਾ ਉਹਦੇ ਨਾਲ ਅਤੇ ਉੱਥੇ ਕੁਲਚੇ ਵੀ ਵਧੀਆ ਮਿਲ ਜਾਂਦੇ ਆ ਉਹਨੇ ਪਾਓ ਵੀ ਰੱਖੇ ਹੋਏ ਆ ਨਾਲ ਪਾਓ ਭਾਜੀ ਟਾਈਪ ਉਹ ਵੀ ਚੀਜ਼ ਮਿਲ ਜਾਵੇਗੀ ਤੈਨੂੰ ਤੂੰ ਆਪਣੀ ਪ੍ਰੈਫਰੈਂਸਸ 'ਚ ਦੱਸ ਕਿਆ ਚਾ ਤੈਨੂੰ ਖਾਣਾ ਕਿਆ ਹੈ ਪੀਜਾ ਕੈਨੇਡੀਅਨ ਪੀਜਾ ਹੈ ਇੱਥੇ ਉੱਥੇ ਵਧੀਆ ਪੀਜਾ ਲਾਇਕ ਵੈਜੀਟੇਰੀਅਨ ਆ ਪਿਓਰ ਵੈਜੀਟੇਰੀਅਨ ਆ ਰੈਸਟੂਰੈਂਟ ਕੋਈ ਨੋਨ ਵੈਜ ਨਹੀਂ ਹੈਗਾ ਹਾਂ ਹਾਂ ਖਾਦਾ ਹੋਇਆ ਹੈ ਲਾਈਕ ਵਧੀਆ ਹੁੰਦਾ ਹੈ ਟੇਸਟ ਵਧੀਆ ਹੈ ਬਾਕੀ ਟਰਾਈ ਕਰਨ 'ਤੇ ਆ ਨਾ ਤੇਰੇ 'ਤੇ ਡਿਪੈਂਡ ਹੈ ਹੁੰ ਹੁੰ ਹਾਂ ਹਾਂ ਜਦੋਂ ਕੋਈ ਨਾ ਜਦੋਂ ਆਵੇਗੀ ਦੱਸਦੀ ਮੈਂ ਵੀ ਚੱਲੂੰਗੀ ਨਾਲ ਥੋੜ੍ਹਾ ਆਊਟਿੰਗ ਹੋ ਜਾਵੇਗੀ ਹਾਂ ਹਾਂ ਗੋਲ ਗੱਪੇ ਦੱਸੇ ਤੈਨੂੰ ਲਾਇਕ ਜਿਵੇਂ ਜਿਹੜਾ ਇੱਥੇ ਕਰਮ ਚੰਦ ਲਾਈਕ ਜਿੱਥੇ ਮਿਠਾਈ ਵਾਲਾ ਸ਼ੋਪ ਆ ਮਾਰਕੀਟ 'ਚ ਮੇਨ ਮਾਰਕੀਟ 'ਚ ਉੱਥੇ ਨਾਲ ਹੀ ਸਮੋਸਿਆਂ ਵਾਲੀ ਰੇਹੜੀ ਵੀ ਹੈਗੀ ਹੈ ਸਮੋਸੇ ਸਪਰਿੰਗ ਰੋਲ ਵੀ ਮਿਲ ਜਾਣਗੇ ਐਂ ਮਤਲਬ ਡਿਸ਼ਜ਼ ਕਾਫ਼ੀ ਮਿਲ ਜਾਂਦੀਆਂ ਟਰਾਈ ਕਰਨ 'ਤੇ ਹੈ ਹਾਂ ਹਾਂ ਹਾਂ ਹਾਂ ਜਦੋਂ ਮਰਜੀ